ਪੰਜਾਬ ਦੇ ਨਿਵਾਸੀ ਆਪਣੀ ਸਿਹਤ ਦੇ ਪੱਖੋਂ ਹੀ ਜਾਣੇ ਜਾਂਦੇ ਨੇ ਕਿਉਂਕਿ ਇਹ ਆਪਣੇ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਹੀ ਯੂਜ ਕਰਦੇ ਆ ਖਾਂਦੇ ਆ ਪੀਂਦੇ ਆ ਸਭ ਕੁਛ ਘਰ ਦੀਆਂ ਬਣੀਆਂ ਹੀ ਚੀਜ਼ਾਂ ਕਰਦੇ ਆ ਮੈਂ ਵੀ ਪੰਜਾਬ ਦੀ ਨਿਵਾਸੀ ਹਾਂ ਮੈਂ ਵੀ ਆਪਣੀਆਂ ਸਾਰੀਆਂ ਚੀਜ਼ਾਂ ਘਰ ਤੋਂ ਹੀ ਬਣੀਆਂ ਹੋਈਆਂ ਪਸੰਦ ਕਰਦੀ ਹਾਂ ਤਾਂ ਜਿਵੇਂ ਕਿ ਫਲ ਫੁਲ ਸਬਜ਼ੀਆਂ ਤਾਂ ਅਸੀਂ ਇਹ ਚੀਜ਼ਾਂ ਘਰੇ ਹੀ ਉਗਾਉਂਦੇ ਹਾਂ ਸਾਡੇ ਘਰ ਖੁੱਲ੍ਹੇ ਖੇਤ ਖੁੱਲ੍ਹੇ ਹੁੰਦੇ ਨੇ ਤਾਂ ਅਸੀਂ ਇਹ ਚੀਜ਼ਾਂ ਘਰੇ ਹੀ ਉਗਾਉਂਦੇ ਹਾਂ ਜ਼ਿਆਦਾਤਰ ਅਸੀਂ ਫਲ ਅਤੇ ਸਬਜ਼ੀਆਂ ਘਰ ਹੀ ਉਗਾਉਂਦੇ ਹਾਂ ਤਾਂ ਕਿ ਬੱਚਿਆਂ ਨੂੰ ਤਾਜ਼ਾ ਫਲ ਦਿੱਤੇ ਜਾਣ ਜਿਵੇਂ ਕਿ ਅੱਜ ਕੱਲ੍ਹ ਬਜ਼ਾਰਾਂ ਵਿੱਚ ਬਹੁਤ ਜ਼ਿਆਦਾ ਰਸਾਇਣਿਕ ਉੱਪਰ ਚੀਜ਼ਾਂ ਕੈਮੀਕਲ ਯੂਜ ਕੀਤੇ ਜਾਂਦੇ ਆ ਤਾਂ ਉਹਨਾਂ ਤੋਂ ਬਚਣ ਲਈ ਅਸੀਂ ਆਪਣੀਆਂ ਸਬਜ਼ੀਆਂ ਅਤੇ ਫਲ ਘਰ ਹੀ ਉਗਾਉਂਦੇ ਹਾਂ ਉਹਨਾਂ ਨਾਲ ਇੱਕ ਤਾਂ ਮਹਿੰਗਾਈ ਦੇ ਉਸ ਚੀਜ਼ ਤੋਂ ਬਚਿਆ ਜਾਂਦਾ ਹੈ ਅਸੀਂ ਆਪਦੇ ਘਰ ਵਾਲੀਆਂ ਹੀ ਸਬਜ਼ੀਆਂ ਅਤੇ ਫਲ ਯੂਜ ਕਰਕੇ ਖਾਂਦੇ ਹਾਂ ਅਤੇ ਬੱਚਿਆਂ ਨੂੰ ਵੀ ਉਹੀ ਚੀਜ਼ ਦਿੰਦੇ ਹਾਂ ਤਾਂ ਕਿ ਬੱਚੇ ਵੀ ਹੈਲਦੀ ਰਹਿਣ